ਭੰਗੜਾ ਇੱਕ ਪ੍ਰਸਿੱਧ ਪੰਜਾਬੀ ਲੋਕ ਨਾਚ ਹੈ ਇਹ ਸਾਰੇ ਪੰਜਾਬ ਵਿੱਚ ਪ੍ਰਸਿੱਧ ਹੈ ਭੰਗੜਾ ਪੰਜਾਬ ਦੇ ਵੱਖ ਵੱਖ ਦੇਸ਼ਾਂ ਵਿੱਚ ਪਾਇਆ ਜਾਂਦਾ ਹੈ ਪ੍ਰਮੁੱਖ ਲੋਕਨਾਚ ਵਿੱਚੋਂ ਹੈ ਦੂਜਾ ਪ੍ਰਮੁੱਖ ਨਾਚ ਗਿੱਧਾ ਹੈ ਆਮ ਤੌਰ 'ਤੇ ਭੰਗੜਾ ਨੌਜਵਾਨ ਗੱਭਰੂ ਕਰਦੇ ਹਨ ਅਤੇ ਗਿੱਧਾ ਮੁਟਿਆਰਾਂ ਪਾਉਂਦੀਆਂ ਹਨ ਭੰਗੜਾ ਹਰ ਇੱਕ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਜਿਵੇਂ ਕਿ ਮੇਲੇ ਤਿਉਹਾਰ ਵਿਆਹ ਸ਼ਾਦੀ ਜਾਂ ਕਣਕ ਦੀ ਵਾਢੀ ਸਮੇਂ ਵਿਸਾਖੀ ਸਮੇਂ ਆਦਿ ਥਾਵਾਂ 'ਤੇ ਪਾਇਆ ਜਾਂਦਾ ਹੈ ਇਹ ਲੋਕ ਨਾਚ ਪੰਜਾਬ ਦੀ ਕਿਸਾਨੀ ਸੰਸਕ੍ਰਿਤ ਵਾਂਗ ਹੀ ਪ੍ਰਾਚੀਨ ਹੈ ਭੰਗੜਾ ਪਹਿਲਾ ਪੱਛਮੀ ਪੰਜਾਬ ਦੇ ਜ਼ਿਲ੍ਹੇ ਸ਼ੇਰਪੁਰ ਪੱਛਮੀ ਗੁਜਰਾਤ ਦੇ ਅਤੇ ਸਿਆਲਕੋਟ ਵਿੱਚ ਜ਼ਿਆਦਾ ਪ੍ਰਚਲਿਤ ਹੈ ਅੱਜ ਕੱਲ੍ਹ ਪੰਜਾਬ ਵਿੱਚ ਭੰਗੜਾ ਬਹੁਤ ਮਸ਼ਹੂਰ ਹੈ ਅਤੇ ਗਿੱਧਾ ਵੀ ਬਹੁਤ ਮਸ਼ਹੂਰ ਹੈ ਵਿਸਾਖੀ ਸਮੇਂ ਕਣਕ ਦੀ ਵਾਢੀ ਨਾਲ ਹੀ ਉਸ ਸਮੇਂ ਲੋਕ ਖੁਸ਼ੀ ਵਿੱਚ ਭੰਗੜਾ ਪਾਉਂਦੇ ਹਨ ਅਤੇ ਮੁਟਿਆਰਾਂ ਗਿੱਧਾ ਪਾਉਂਦੀਆਂ ਹਨ ਭੰਗੜੇ ਵਿੱਚ ਸਾਜ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਭੰਗੜੇ ਦਾ ਪ੍ਰਮੁੱਖ ਨਾ ਸਾਜ ਹੈ ਭੰਗੜੇ ਦੇ ਕੁਝ ਆਮ ਸਟੈਪ ਹਨ ਜਿਵੇਂ ਕਿ ਝੁੰਮਰ ਗਿੱਧਾ ਆਦਿ ਭੰਗੜੇ ਦੇ ਬਹੁਤ ਸਾਰੇ ਨੌਜਵਾਨ ਇਸ ਨੂੰ ਇਸ ਵਿੱਚ ਭਾਗ ਲੈ ਰਹੇ ਹਨ ਅਤੇ ਭੰਗੜਾ ਪੰਜਾਬ ਦਾ ਬਹੁਤ ਪ੍ਰਸਿੱਧ ਲੋਕ ਨਾਚ ਹੈ ਜੋ ਕਿ ਸਾਰੇ ਇਸ ਨੂੰ ਚਾਵਾਂ ਨਾਲ ਪਾਉਂਦੇ ਹਨ ਭੰਗੜਾ ਕਰਦੇ ਸਮੇਂ ਬਹੁਤ ਹੀ ਖੁਸ਼ ਹੁੰਦੇ ਹਨ ਅਤੇ ਜਿਸ ਨੂੰ ਜਿਸ ਦੋ ਜੋ ਦੇਖਦੇ ਹਨ ਉਹ ਵੀ ਬਹੁਤ ਖੁਸ਼ ਹੁੰਦੇ ਹਨ ਇਸ ਕਰਕੇ ਭੰਗੜਾ ਅਤੇ ਗਿੱਧਾ ਪੰਜਾਬ ਦਾ ਲੋਕ ਨਾਚ ਗਿੱਧਾ ਹੈ ਇਹ 'ਚ ਬਹੁਤ ਬਹੁਤ ਸਾਰੇ ਬੱਚੇ ਭਾਗ ਲੈਂਦੇ ਹਨ ਅਤੇ ਨੌਜਵਾਨ ਵਜੋਂ